ਬਹੁਤ ਸਾਰੀਆਂ ਲਾਇਬ੍ਰੇਰੀਆਂ ਹਨ ਜੋ ਮੈਂ ਵੇਖੀਆਂ ਹਨ ਅਤੇ ਵੇਖਦੀ ਹਾਂ ਜਿਵੇਂ ਹਰ ਸਕੂਲ ਦੇ ਵਿੱਚ ਵੀ ਛੋਟੀ ਜਿਹੀ ਲਾਇਬ੍ਰੇਰੀ ਹੁੰਦੀ ਹੈ ਸਾਡੇ ਸਕੂਲ ਵਿੱਚ ਵੀ ਸੀ ਫਿਰ ਕਾਲਜ ਦੇ ਪੜ੍ਹੇ ਤਾਂ ਕਾਲਜ ਦੇ ਵਿੱਚ ਵੀ ਬਹੁਤ ਵੱਡੀ ਲਾਇਬ੍ਰੇਰੀ ਸੀ ਜਿੱਥੋਂ ਮੈਂ ਅਕਸਰ ਹੀ ਕਿਤਾਬਾਂ ਇਸ਼ੂ ਕਰਵਾਉਂਦੀ ਰਹਿੰਦੀ ਸੀ ਅਤੇ ਪੜ੍ਹਦੀ ਰਹਿੰਦੀ ਸੀ ਫਿਰ ਯੂਨੀਵਰਸਿਟੀ ਗਈ ਯੂਨੀਵਰਸਿਟੀ ਦੀ ਲਾਇਬ੍ਰੇਰੀ ਤਾਂ ਬਹੁਤ ਵੱਡੀ ਹੈ ਹੁਣ ਜਿਸ ਕਾਲਜ ਵਿੱਚ ਮੈਂ ਪੜ੍ਹਾਉਂਦੀ ਹਾਂ ਉੱਥੇ ਵੀ ਬਹੁਤ ਵੱਡੀ ਲਾਇਬ੍ਰੇਰੀ ਹੈ ਤਾਂ ਇਸ ਪ੍ਰਕਾਰ ਬਹੁਤ ਸਾਰੀਆਂ ਲਾਇਬ੍ਰੇਰੀਆਂ ਹਨ ਅਤੇ ਲਾਇਬ੍ਰੇਰੀ ਜਾਣਾ ਮੈਨੂੰ ਬਹੁਤ ਪਸੰਦ ਹੈ ਪੜ੍ਹਨਾ ਮੈਨੂੰ ਬਹੁਤ ਪਸੰਦ ਹੈ ਅਤੇ ਮੇਰਾ ਇਹ ਸੁਪਨਾ ਹੈ ਕਿ ਮਤਲਬ ਮੇਰੇ ਘਰ ਦੇ ਵਿੱਚ ਵੀ ਇੱਕ ਬੜੀ ਸੋਹਣੀ ਲਾਇਬ੍ਰੇਰੀ ਹੋਏ ਜਿਹਦੇ ਵਿੱਚ ਪੰਜਾਬੀ ਦੇ ਹਰ ਲੇਖਕ ਦੀ ਕੋਈ ਨਾ ਕੋਈ ਕਿਤਾਬ ਹੋਏ ਜਿਸ ਪ੍ਰਕਾਰ ਮੈਨੂੰ ਡੋਕਟਰ ਦਲੀਪ ਕੌਰ ਟਿਵਾਣਾ ਦੇ ਨਾਵਲ ਪੜ੍ਹਨੇ ਬਹੁਤ ਪਸੰਦ ਹਨ ਇਸ ਤਰ੍ਹਾਂ ਜਸਵੰਤ ਸਿੰਘ ਕੰਵਲ ਦੇ ਨਾਵਲ ਸਾਡਾ ਸਮਕਾਲੀ ਲੇਖਕ ਹੈ ਸੁਰਜੀਤ ਪਾਤਰ ਉਹਦੀਆਂ ਕਵਿਤਾਵਾਂ ਪੜ੍ਹਨੀਆਂ ਮੈਨੂੰ ਬਹੁਤ ਪਸੰਦ ਨੇ ਇਸ ਤਰ੍ਹਾਂ ਕਹਾਣੀਆਂ ਪੰਜਾਬੀ ਦਾ ਲਿਟਰੇਚਰ ਸਾਹਿਤ ਪੜ੍ਹਨਾ ਮੈਨੂੰ ਬਹੁਤ ਪਸੰਦ ਹੈ ਤਾਂ ਮੇਰੇ ਘਰ ਦੇ ਵਿੱਚ ਜਦੋਂ ਵੀ ਮੈਂ ਬੜੀ ਸੋਹਣੀ ਜਿਹੀ ਲਾਇਬ੍ਰੇਰੀ ਬਣਾਵਾਂਗੀ ਤਾਂ ਇਹਨਾਂ ਸਾਰੇ ਲੇਖਕਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉੱਥੇ ਜ਼ਰੂਰ ਰੱਖਾਂਗੀ